ਬਾਈ ਜਨਵਰੀ ਉੱਨੀ ਸੌ ਛਿਆਨਵੇਂ ਤੇਰ੍ਹਾਂ ਅਪ੍ਰੈਲ ਉੱਨੀ ਸੌ ਸੱਤਰ ਛੇ ਅਪ੍ਰੈਲ ਉੱਨੀ ਸੌ ਛਿਆਨਵੇਂ ਦੋ ਸਤੰਬਰ ਉੱਨੀ ਸੌ ਅਠਾਨਵੇਂ ਅੱਠ ਅਕਤੂਬਰ ਉੱਨੀ ਸੌ ਸੱਤਰ